ਰਸੋਈ ਵਿੱਚ ਹਰ ਬਰਤਨ ਕੰਮ ਆਉਂਦਾ ਹੈ ਕੋਈ ਵੀ ਹੋਵੇ ਭਾਵੇਂ ਗਲਾਸ ਹੋਵੇ ਭਾਵੇਂ ਕੋਲੀ ਹੋਵੇ ਕੋਈ ਥਾਲੀ ਹੋਵੇ ਜਾਂ ਕੁੱਕਰ ਹੋਵੇ ਪਿਛਲੇ ਜ਼ਮਾਨੇ 'ਚ ਵੱਡੇ ਵੱਡੇ ਗਲਾਸ ਕੜੇ ਵਾਲੇ ਹੁੰਦੇ ਸੀ ਉਹਦੇ 'ਚ ਲੋ ਲੋਕੀ ਲੱਸੀ ਪੀਂਦੇ ਹੁੰਦੇ ਸੀ ਅਤੇ ਦੁੱਧ ਪੀਂਦੇ ਸੀਗੇ ਹੁਣ ਬਹੁਤ ਮਤਲਬ ਕੱਚ ਦੇ ਭਾਂਡੇ ਵੀ ਹੁੰਦੇ ਸੀ ਕੱਚ ਦੇ ਭਾਂਡੇ ਤਾਂਬੇ ਦੇ ਭਾਂਡੇ ਲੋਹੇ ਦੇ ਭਾਂਡੇ ਇਹਨਾਂ ਸਾਰਿਆਂ ਵਰਤੋਂ ਆਉਂਦੇ ਸੀਗੇ ਇਹ ਬਹੁਤ ਜ਼ਿਆਦਾ ਲੋਕ ਜਿਹੜੇ ਉਹ ਛੰਨਿਆਂ ਦੇ ਵਿੱਚ ਮਤਲਬ ਜ਼ਿਆਦਾ ਮਤਲਬ ਪ੍ਰਯੋਗ ਕਰਦੇ ਸੀਗੇ ਛੰਨਿਆਂ ਨੂੰ ਕਾਂਚ ਦੇ ਕੱਚ ਦੇ ਭਾਂਡੇ ਕਹਿਣ ਦਾ ਮਤਲਬ ਕੱਚ ਦੇ ਭਾਂਡਿਆਂ ਨੂੰ ਹਰ ਇੱਕ ਚੀਜ਼ ਵਰਤੋਂ ਆਉਂਦੀ ਏ ਉਹਦੇ ਪਹਿਲਾਂ ਸਭ ਤੋਂ ਪਹਿਲਾਂ ਕੁੱਕਰ ਹੀ ਏ ਉਹਦੇ ਵਿੱਚ ਜੋ ਮਰਜ਼ੀ ਬਣਾ ਲਓ ਜੋ ਮਰਜ਼ੀ ਬਣਾ ਕੇ ਉਹਨੂੰ ਪਤੀਲੇ 'ਚ ਰੱਖ ਲਓ ਕੱਢ ਕੇ ਫਿਰ ਉਹਨੂੰ ਗਲਾਸਾਂ 'ਚ ਕੋਲੀਆਂ 'ਚ ਸਰਵ ਕਰੋ ਬਹੁਤ ਅੱਛਾ ਲੱਗ ਰਿਹਾ ਸਾਰੇ ਇੱਕੋ ਜਿਹੇ ਬਰਤਨ ਹੋਏ ਹੋਣ ਉਹ ਵੀ ਅੱਛਾ ਲੱਗਦਾ ਵਾ ਅੱਛੇ ਲੱਗਦੇ ਰਸੋਈ ਦੇ ਵਿੱਚ ਸਾਰੇ ਬਰਤਨ ਜਿਹੜੇ ਹੈ ਇਕ ਸਾਰ ਰੱਖੇ ਜਾਂਦੇ ਆ ਅਤੇ ਬਹੁਤ ਮਤਲਬ ਉਹ ਨਾ ਸੋਹਣੇ ਲੱਗਦੇ ਆ ਆਉਣ ਵਾਲੇ ਨੂੰ ਵੀ ਸੋਹਣੇ ਲੱਗਦੇ ਬਰਤਨ ਵਾਲੇ ਨੂੰ ਵੀ ਸੋਹਣੇ ਲੱਗਦੇ ਆ ਇਸ ਕਰਕੇ ਹਰ ਹਰ ਬਰਤਨ ਜਿਹੜਾ ਉਹ ਮਤਲਬ ਵਰਤਿਆ ਜਾਂਦਾ ਵਾ ਕੋਈ ਵੀ ਜਿਹੜਾ ਬਰਤਨ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਉਸ ਨੂੰ ਯੂਜ ਕਰੋ ਧੰਨਵਾਦ